ਟੈਕਨੋਲਜੀ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਭਾਸ਼ਾ ਕੁਝ ਸਰਲ ਵੀ ਹੋਈ ਹੈ ਅਤੇ ਕੁਝ ਔਖੀ ਵੀ ਹੋ ਗਈ ਹੈ ਅਜੋਕੀ ਪੀੜੀ ਦੇ ਵਿੱਚ ਜੋ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਪੰਜਾਬੀ ਅੱਖਰਾਂ ਦੀ ਪਹਿਚਾਣ ਬਿਲਕੁਲ ਭੁੱਲ ਗਈ ਹੈ ਅਤੇ ਜੋ ਓਲਡ ਏਜ਼ ਨੇ ਉਹ ਪੰਜਾਬੀ ਅੱਖਰ ਨੂੰ ਹਰ ਅੱਖਰ ਦੀ ਉਹਨਾਂ ਦੀ ਸਮਝ ਹੁੰਦੀ ਹੈ ਅਤੇ ਜਦੋਂ ਵੀ ਮੰਨ ਲਉ ਆਪਾਂ ਕਿਸੇ ਵੀ ਚੀਜ਼ 'ਤੇ ਕੋਈ ਟੇ ਮੈਸਿਜ਼ ਟਾਈਪ ਕਰਦੇ ਹਾਂ ਤਾਂ ਉਦੋਂ ਮਤਲਬ ਕਿਸੇ ਵੀ ਅੱਖਰ 'ਤੇ ਅਸੀਂ ਟਾਈਪ ਕਰਦੇ ਉਹਦੇ ਨਾਲ ਹੋਰ ਅੱਖਰ ਐਡ ਹੋ ਜਾਂਦਾ ਜੇ ਇਹ ਇਹ ਮੈਨੂੰ ਵੀ ਬਹੁਤ ਜਾਣੀ ਬ ਬੁਰਾ ਲੱਗਦਾ ਹੈ ਕਿਉਂਕਿ ਅਸੀਂ ਇੱਕ ਇੱਕ ਅੱਖਰ ਦੀ ਪਹਿਚਾਣ ਕਰਕੇ ਹੀ ਟਾਈਪ ਕਰਦੇ ਹਾਂ ਟਾਈਪ ਕਰਨ ਦੌਰਾਨ ਕੁਝ ਗਲਤ ਵੀ ਹੋ ਜਾਂਦਾ ਹੈ ਕੁਛ ਟੈਕਨੋਲਜੀ ਦੇ ਨਾਲ ਆਸਾਨ ਵੀ ਹੋ ਰਿਹਾ ਹੇ